ਪੰਜਾਬ ਵਿੱਚ ਬਹੁਤ ਜ਼ਿਆਦਾ ਧਾਰਮਿਕ ਪਰੰਪਰਾਵਾਂ ਅਤੇ ਰਸਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਹੋਲਾ ਮਹੱਲਾ ਅਤੇ ਹੋਰ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਭੇਟਾਂ ਮਾਤਾ ਦੇ ਚਾਲੇ ਚੱਲਦੇ ਹੈ ਅਤੇ ਲੰਗਰ ਵਗੈਰਾ ਲਗਾਏ ਜਾਂਦੇ ਹੈ ਰਸਮਾਂ ਸਾਡੀਆਂ ਆਪਣੀਆਂ ਵਿਰਾਸਤੀ ਰਸਮਾਂ ਜਿਹੜੀਆਂ ਪਰਿਵਾਰਕ ਰਸਮਾਂ ਹੁੰਦੀਆਂ ਜਿਵੇਂ ਭੈਣਾਂ ਭਰਾਵਾਂ ਦੇ ਕੋਈ ਰਿਸ਼ਤੇ ਹੁੰਦੇ ਹੈ ਤੀਰਥ ਯਾਤਰਾਵਾਂ ਲੋਕ ਤੀਰਥਾਂ 'ਤੇ ਜਾਂਦੇ ਹੈ ਕੋਈ ਮੰਦਰ ਜਾਂਦਾ ਕੋਈ ਗੁਰਦੁਆਰੇ ਜਾਂਦਾ ਕੋਈ ਮਸਜਿਦ 'ਚ ਜਾਂਦਾ ਦੂਰ ਦੁਰਾਡੇ ਜਿਹੜੀਆਂ ਇਤਿਹਾਸਕ ਸਥਾਨ ਬਣੇ ਹੋਏ ਉਹਨਾਂ ਦੀਆਂ ਦਰਸ਼ਨ ਕਰਨ ਵਾਸਤੇ